ਖ਼ਬਰਾਂ ਵਿੱਚ ਬਹੁਤ ਸਮਾਜਿਕ ਸੱਭਿਆਚਾਰ ਮੁੱਦੇ ਵਿਚਾਰੇ ਜਾਂਦੇ ਹਨ ਜਿਵੇਂ ਕਿ ਬੋਲੀਆਂ ਹੋ ਗਈਆਂ ਭੰਗੜਾ ਹੋ ਗਏ ਇਹ ਪੰਜਾਬ ਦੇ ਬਹੁਤ ਮਸ਼ਹੂਰ ਸੱਭਿਆਚਾਰਾਂ ਵਿੱਚੋਂ ਇੱਕ ਨੇ ਬੋਲੀਆਂ ਸਾਡੇ ਪੰਜਾਬ ਦੀ ਸ਼ਾਨ ਹੈ ਅੋਰ ਭੰਗੜਾ ਵੀ ਜੋ ਕਿ ਖ਼ਬਰਾਂ ਵਿੱਚ ਆਉਂਦੇ ਹਨ ਕਈ ਜਣੇ ਇਸਨੂੰ ਨੈਗੇਟਿਵ ਵੇਅ 'ਚ ਲੈਂਦੇ ਨੇ ਕਈ ਪੋਜਟਿਵ 'ਚ ਕੋਈ ਨੈਗੇਟਿਵ ਵੇਅ 'ਚ ਖ਼ਬਰਾਂ 'ਚ ਪਾਉਂਦੇ ਹੈ ਕਿਸੇ ਨੂੰ ਨਹੀਂ ਪਸੰਦ ਹੁੰਦੀਆਂ ਉਹ ਨੈਗਟਿਵ 'ਚ ਲੈ ਜਾਂਦੇ ਹੈ ਜਿਹਨਾਂ ਨੂੰ ਬਹੁਤ ਪਸੰਦ ਹੁੰਦੀਆਂ ਵਾ ਉਹ ਇਸਨੂੰ ਵੱਧ ਤੋਂ ਵੱਧ ਪਾਉਂਦੇ ਨੇ ਖ਼ਬਰਾਂ 'ਚ ਅਤੇ ਸਕੂਲਾਂ 'ਚ ਕੋਲਜਾਂ ਵਿੱਚ ਹਰ ਥਾਂ 'ਤੇ ਬੋਲੀਆਂ ਅਤੇ ਭੰਗੜਾ ਬਹੁਤ ਮਸ਼ਹੂਰ ਹੁੰਦੇ ਨੇ ਇਹਨਾਂ ਦੇ ਕੋਂਪੀਟੀਸ਼ਨਸ ਹੁੰਦੇ ਨੇ ਫਿਰ ਪ੍ਰਾਇਜ ਮਿਲਦੇ ਹਨ ਉਨ੍ਹਾਂ ਦੀ ਵੀ ਖ਼ਬਰਾਂ ਪੈਂਦੀਆਂ ਹਨ ਸਾਡੇ ਪੰਜਾਬ 'ਚ ਸ ਸੱਭਿਆਚਾਰ ਨੂੰ ਭੰਗੜਾ ਹੀ ਕਹਿੰਦੇ ਹਨ ਇਹ ਬਹੁਤ ਮਸ਼ਹੂਰ ਹੈ